ਹੈਲੋ ਹਾਂਜੀ ਕੌਣ ਬੋਲ ਰਹੇ ਹਾਂਜੀ ਅਨੂ ਸ਼ਰਮਾ ਕਿਹਦੇ ਰਿਗਾਰਡਿੰਗ ਕੋਲ ਕੀਤੀ ਸੀ ਤੁਸੀਂ

ਹਾਂਜੀ ਹਾਂਜੀ ਉੱਥੋਂ ਹੀ ਬੋਲ ਰਹੇ ਹਾਂ ਮੈਮ ਅਸੀਂ ਠੀਕ ਹੈ ਠੀਕ ਹੈ ਮੈਮ ਕੀ ਨਾਮ ਦੱਸਿਆ ਤੁਸੀਂ ਸਟੂਡੈਂਟ ਦਾ ਅੱਛਾ ਕ੍ਰਿਸ਼ਨਾ ਸ਼ਰਮਾ ਓਕੇ ਕੋਈ ਨਹੀਂ ਮੈਮ ਮੈਂ ਤੁਹਾਨੂੰ ਓਹਨਾਂ ਦੇ ਜਿਹੜੇ ਯੂਨਿਟ ਟੈਸਟ ਹੋਏ ਆ ਮੈਂ ਤੁਹਾਨੂੰ ਓਹਨਾਂ ਦੇ ਮਾਕਸ ਦੱਸ ਦਿੰਦੀ ਹਾਂ ਵੈਸੇ ਜਦ ਮੀਟਿੰਗ ਹੁੰਦੀ ਨਾ ਤਾਂ ਕੋਸ਼ਿਸ਼ ਕਰਿਆ ਕਰੋ ਕਿ ਅਟੈਂਡ ਕਰ ਲਈ ਜਾਵੇ ਕਿਉਂਕਿ ਫਿਰ ਬੱਚਿਆਂ ਦੀ ਫੀਡਬੈਕ ਦੇਣ 'ਚ ਆਸਾਨੀ ਹੁੰਦੀ ਆ ਸਾਨੂੰ ਵੀ

ਚਲੋ ਕੋਈ ਨਾ ਮੈਮ ਕੋਈ ਨਹੀਂ ਮੈਂ ਤੁਹਾਨੂੰ ਉਹਦੀ ਜੋ ਵੀ ਰਿਪੋਰਟ ਹੈ ਮੈਂ ਦੱਸ ਦਿੰਦੀ ਹਾਂ ਤੁਹਾਨੂੰ ਉਹਨਾਂ ਦੇ ਜਿਹੜੇ ਮਾਕਸ ਆ ਉਹਨਾਂ ਦੀ ਇੰਗਲਿਸ਼ ਵਿੱਚੋਂ ਮਾਕਸ ਆਏ ਹੈਗੇ ਆ ਫੋਰਟੀ ਫਾਈਵ ਆਊਟ ਔਫ ਸੈਵਨਟੀ ਅਤੇ ਹਿੰਦੀ ਵਿੱਚ ਉਹਦੇ ਆਏ ਹੈਗੇ ਆ ਥਰਟੀ ਸਿਕਸ ਅਤੇ ਮੈਥ ਵਿੱਚੋਂ ਫੋਰਟੀ ਆਏ ਆ ਐਂਡ ਈਵੀਐੱਸ ਵਿੱਚੋਂ ਉਹਦੇ ਆਏ ਹੈਗੇ ਆ ਫਿਫਟੀ ਵਨ ਓਵਰਆਲ ਮਤਲਬ ਮਾਕਸ ਹੀ ਆਏ ਆ ਉਹਨਾਂ ਦੇ ਜ਼ਿਆਦਾਤਰ ਉਹਨਾਂ ਨੂੰ ਇੰਪਰੂਵਮੈਂਟ ਦੀ ਅਗਰ ਲੋੜ ਹੈ ਤਾਂ ਉਹ ਹਿੰਦੀ ਸਬਜੈਕਟ ਵਿੱਚੋਂ ਐਂ ਅਤੇ ਕਾਫੀ ਮਾਤਰਾਵਾਂ ਵਗੈਰਾ ਉਹਨਾਂ ਨੂੰ ਇੰਪਰੂਵ ਕਰਨ ਦੀ ਲੋੜ ਹੈਗੀ ਆ ਹਾਂਜੀ ਜ਼ਿਆਦਾਤਰ ਹੋ ਸਕੇ ਤਾਂ ਉਹਨਾਂ ਨੂੰ ਘਰ ਵੀ ਥੋੜ੍ਹੀ ਪ੍ਰੈਕਟਿਸ ਕਰਵਾਇਆ ਕਰੋ ਕਿ ਆਪਣੀ ਹਿੰਦੀ ਨੂੰ ਥੋੜ੍ਹਾ ਇੰਪਰੂਵ ਕਰ ਸਕਣ ਹਾਂਜੀ ਹਾਂਜੀ ਮੈਮ ਬਸ ਇੱਦਾਂ ਆ ਕਿ ਥੋੜ੍ਹੀ ਖੱਪ ਜ਼ਿਆਦਾ ਕਰਦੇ ਆ ਬੱਚੇ ਅਤੇ ਥੋੜ੍ਹਾ ਹੁਣ ਤਾਂ ਥੋੜ੍ਹਾ ਕੰਟਰੋਲ ਵਿੱਚ ਆ ਗਿਆ ਆ ਕਾਫੀ ਪਹਿਲਾਂ ਨਾਲੋਂ ਕਾਫੀ ਕਲਾਸ ਲੱਗੀ ਕਰਕੇ ਇਹ ਵੀ ਥੋੜ੍ਹਾ ਕੰਟਰੋਲ ਵਿੱਚ ਆ ਹੁਣ ਹਾਂਜੀ ਹੁਣ ਕਾਫੀ ਘੱਟ ਗਿਆ ਪਰ ਥੋੜ੍ਹਾ ਪੜ੍ਹਾਈ ਦੇ ਪੱਖੋਂ ਥੋੜ੍ਹੀ ਇੰਪਰੂਵਮੈਂਟ ਆ ਜਾਵੇ ਤਾਂ ਬੈਟਰ ਹੈ ਓਕੇ ਓਕੇ ਓਕੇ ਠੀਕ ਆ ਜੀ ਓਕੇ